ਹੈਲੋ ਤੁਸੀਂ ਬਾਂਸਲ ਸਵੀਟ ਤੋਂ ਬੋਲਦੇ ਪਏ ਹੋ ਮੈਨੂੰ ਨਾ ਵਿਆਹ ਦੇ ਲਈ ਨਾ ਪੰਜਾਹ ਕਿੱਲੋ ਲੱਡੂ ਦੀ ਲੋੜ ਹੈਗੀ ਹੈ ਅਤੇ ਤੁਹਾਡੇ ਇਕ ਕਿੱਲੋ ਲੱਡੂ ਦੀ ਕੀਮਤ ਕੀ ਹੈਗੀ ਹੈ ਇੱਕ ਸੌ ਸੱਠ ਰੁਪਏ ਕਿੱਲੋ ਚਲੋ ਠੀਕ ਹੈ ਮੈਂ ਤੁਹਾਨੂੰ ਦੁਬਾਰਾ ਤੋਂ ਫੋਨ ਕਰਦੀ ਹਾਂ ਹੈਲੋ ਆਹੂਜਾ ਸਵੀਟ ਤੋਂ ਬੋਲਦੇ ਪਏ ਹੋ ਮੈਨੂੰ ਵਿਆਹ ਲਈ ਪੰਜਾਹ ਕਿੱਲੋ ਲੱਡੂ ਦੀ ਲੋੜ ਹੈ ਅਤੇ ਇੱਕ ਕਿੱਲੋ ਦੀ ਕੀ ਪ੍ਰਾਈਜ ਹੈਗੀ ਹੈ ਰੇਟ ਹੈਗਾ ਵਾ ਅਤੇ ਤੁਸੀਂ ਦੱਸੋ ਕਿੰਨਾ ਤੁਹਾਡੇ ਬਣੇਗਾ ਬਿਲ ਜੀ ਇੱਕ ਕਿੱਲੋ ਦੇ ਇੱਕ ਸੌ ਚਾਲੀ ਰੁਪਏ ਕਿੱਲੋ ਚਲੋ ਕੋਈ ਗੱਲ ਨਹੀਂ ਜੇ ਤੁਹਾਡਾ ਇੱਕ ਸੌ ਚਾਲੀ ਰੁਪਏ ਕਿੱਲੋ ਹੈ ਤਾਂ ਮੈਂ ਤੁਹਾਨੂੰ ਥੋੜ੍ਹੀ ਦੇਰ ਰੁਕ ਕੇ ਫੋਨ ਕਰਦੀ ਹਾਂ ਹੈਲੋ ਤੁਸੀਂ ਕਾਨਾ ਸਟੀਵ ਤੋਂ ਬੋਲਦੇ ਹਨ ਮੈਨੂੰ ਪੰਜਾਹ ਕਿੱਲੋ ਲੱਡੂ ਚਾਹੀਦੇ ਆ ਵਿਆਹ ਲਈ ਅਤੇ ਸ ਮੈਨੂੰ ਇੱਕ ਕਿੱਲੋ ਦੇ ਲੱਡੂ ਦੀ ਕੀਮਤ ਦੱਸੋ ਕੀ ਹੋਏਗੀ ਤੁਹਾਡੀ ਤੁਹਾਡੀ ਇੱਕ ਸੌ ਤੀਹ ਰੁਪਏ ਕਿੱਲੋ ਹੈ ਠੀਕ ਹੈ ਮੈਂ ਤੁਹਾਨੂੰ ਥੋੜ੍ਹੀ ਦੇਰ ਬਾਅਦ ਰੁਕ ਕੇ ਫੋਨ ਕਰਦੀ ਹਾਂ ਇਹਨਾਂ ਵਿੱਚੋਂ ਤਾਂ ਕਾਨਾ ਕਾਨਾ ਸਵੀਟ ਦੀ ਹੀ ਮਿਠਾਈ ਵੀ ਬਹੁਤ ਵਧੀਆ ਹੁੰਦੀ ਹੈ ਅਤੇ ਉਹਨਾਂ ਦੀ ਕੀਮਤ ਹੀ ਘੱਟ ਹੁੰਦੀ ਹੈ ਚਲੋ ਮੈਂ ਕਾਨਾ ਸਵੀਟ ਨੂੰ ਹੀ ਫੋਨ ਕਰਦੀ ਹਾਂ ਹੈਲੋ ਕਾਨਾ ਮਿਸ਼ਠਾਨ ਭੰਡਾਰ ਹਾਂਜੀ ਤੁਸੀਂ ਦੱਸੋ ਤੁਹਾਡੇ ਜਿਹੜੇ ਲੱਡੂ ਹੈ ਮੈਂ ਆਪਣੇ ਬੇਟੇ ਦੇ ਵਿਆਹ ਲਈ ਉਹ ਔਡਰ ਦੇਣਾ ਹੈ ਮੈਨੂੰ ਪੰਜਾਹ ਕਿੱਲੋ ਲੱਡੂਆਂ ਦਾ ਆਡਰ ਚਾਹੀਦਾ ਹੈ ਤੁਸੀਂ ਕਿੰਨੇ ਦਿਨਾਂ ਦੇ ਵਿੱਚ ਤਿਆਰ ਕਰਕੇ ਮੈਨੂੰ ਲੱਡੂ ਦੇ ਦਿਉਗੇ ਮੈਨੂੰ ਤੁਸੀਂ ਦੋ ਦਿਨਾਂ ਦੇ ਅੰਦਰ ਤੁਸੀਂ ਅਗਰ ਲੱਡੂ ਤਿਆਰ ਕਰ ਸਕਦੇ ਹਨ ਤਾਂ ਮੇਰੇ ਪੰਜਾਹ ਕਿੱਲੋ ਲੱਡੂਆਂ ਦਾ ਆਡਰ ਲਿਖ ਲਉ ਜੇ ਤੁਹਾਡਾ ਇਹ ਆਡਰ ਭੁਗਤਾਨ ਕਰ ਸਕਦੇ ਹੋ ਤਾਂ ਮੈਨੂੰ ਹੁਣੇ ਹੀ ਦੱਸ ਦਿਉ ਅਤੇ ਤੁਹਾਨੂੰ ਮੈਂ ਪੈਸੇ ਜਦੋਂ ਤੁਹਾਡੇ ਲੱਡੂ ਤੁਸੀਂ ਬਣਾ ਦਿਉਗੇ ਤਾਂ ਮੇਰੇ ਘਰ ਪਹੁੰਚਾ ਦੇਣਾ ਤੁਹਾਨੂੰ ਮੈਂ ਆਪਣ ਤੁਹਾਡਾ ਇਹਨਾਂ ਲੱਡੂਆਂ ਦੀ ਅਡਵਾਂਸ ਪੇਮੈਂਟ ਕਰ ਦੇਵਾਂਗੀ ਤੁਸੀਂ ਮੈਨੂੰ ਲੱ ਦੇ ਦਿਉਗੇ ਪੰਜਾਹ ਕਿੱਲੋ ਲੱਡੂਆਂ ਦਾ ਆਡਰ ਤੁਸੀਂ ਮੈਨੂੰ ਭੁਗਤਾਨ ਕਰ ਸਕਦੇ ਹੋ ਹਾਂਜੀ ਅਸੀਂ ਤੁਹਾਡਾ ਪੰਜਾਹ ਚਲੋ ਇਹ ਤਾਂ ਗੱਲ ਬਹੁਤ ਹੀ ਚੰਗੀ ਹੋਏਗੀ ਮੇਰੇ ਪੰਜਾਹ ਕਿੱਲੋ ਲੱਡੂਆਂ ਮੈਨੂੰ ਇੱਕ ਸੌ ਤੀਹ ਰੁਪਏ ਕਿੱਲੋ ਦੇ ਹਿਸਾਬ ਨਾਲ ਮੈਨੂੰ ਮਿਲ ਗਏ ਹਨ ਅਤੇ ਮੈਂ ਤੁਹਾਡਾ ਇਹ ਤੁਸੀਂ ਮੈਨੂੰ ਇਹ ਆਡਰ ਮੈਨੂੰ ਘਰ ਹੀ ਮਿਲ ਜਾਣਾ ਹੈ ਇਸ ਕਰਕੇ ਕਿਰਪਾ ਕਰਕੇ ਤੁਸੀਂ ਮੇਰਾ ਇਹ ਆਡਰ ਘਰ ਹੀ ਭੇਜ ਦਿਉ ਠੀਕ ਹੈ ਅਤੇ ਮੈਂ ਇਸ ਕਰਕੇ ਤੁਹਾਨੂੰ ਨਾਲ ਹੀ ਪੈਸੇ ਦੇ ਭੇਜਵਾ ਦੇਵਾਂਗੀ